ਸਰ ਮੇਰਾ ਨਾਮ ਭਾਰਤ ਭੂਸ਼ਣ ਪਿੰਡ ਮਿਰਜਾਪੁਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਅਤੇ ਮੇਰਾ ਜਦੋਂ ਮੈਂ ਅੱਠਵੀਂ ਕਲਾਸ ਦੇ ਵਿੱਚ ਸੀ ਪੜ੍ਹਿਆ ਸੀ ਤਾਰਾ ਝੁੰਡ ਬਾਰੇ ਅਤੇ ਮੇਰਾ ਬੜਾ ਮਨ ਕਰਦਾ ਸੀ ਕਿ ਮੈਂ ਤਾਰੇ ਵਗੈਰਾ ਨੂੰ ਦੇਖਾਂ ਖੋਜਾਂ ਇਹਨਾਂ ਬਾਰੇ ਕੁਝ ਨਾ ਕੁਝ ਜਾਣਾ ਅਤੇ ਮੈਂ ਕਾਫੀ ਹੱਦ ਤੱਕ ਕਾਫੀ ਦੇਖਦਾ ਹਾਂ ਆਇਆ ਹਾਂ ਕਿ ਸ਼ਾਮ ਨੂੰ ਜਦੋਂ ਤਾਰੇ ਟਿਮਟਿਮਾਉਂਦੇ ਹਨ ਬਹੁਤ ਸੋਹਣੇ ਲੱਗਦੇ ਹੈ ਅਤੇ ਮੈਂ ਕਾਫੀ ਹੱਦ ਤੱਕ ਜਿੱਦਾਂ ਕਿਤਾਬਾਂ ਵਿੱਚ ਦਿੱਤਾ ਹੁੰਦਾ ਹੈ ਕਿ ਤਾਰਾ ਝੁੰਡ ਇੱਦਾਂ ਦੇ ਦਿੱਖਦੇ ਆ ਤਾਰਾ ਪਿੰਡ ਇੱਦਾਂ ਦੇ ਦਿਖਦੇ ਆ ਸ਼ਾਮ ਨੂੰ ਅਕਸਰ ਮੈਂ ਦੇਖਦਾ ਰਹਿੰਦਾ ਹਾਂ ਇੱਕ ਦਿਨ ਸ਼ਾਮ ਦੇ ਛੇ ਕੁ ਵਜੇ ਦੇ ਕਰੀਬ ਮੈਂ ਆਕਾਸ਼ ਵੱਲ ਦੇਖਦਾ ਪਿਆ ਸੀ ਅਤੇ ਦੇਖਦੇ ਦੇਖਦੇ ਤੇ ਇੱਕ ਤਾਰਿਆਂ ਦੀ ਲੜੀ ਚਲਦੀ ਨਜ਼ਰ ਆਈ ਅਤੇ ਮੈਂ ਆਪਣਾ ਮੋਬਾਈਲ ਕੱਢਿਆ ਅਤੇ ਉਹਦੀ ਵੀਡੀਓ ਸ਼ੂਟ ਕਰਨ ਲੱਗ ਪਿਆ ਅਤੇ ਵੀਡੀਓ ਸ਼ੂਟ ਕਰਨ ਤੋਂ ਬਾਅਦ ਮੈਂ ਉਹਨੂੰ ਨੂੰ ਸੇਫ ਕਰ ਲਿਆ ਅਤੇ ਮੈਂ ਬਹੁਤ ਹੈਰਾਨ ਹੋਇਆ ਪਹਿਲੀ ਵਾਰ 'ਤੇ ਦ੍ਰਿਸ਼ ਦੇਖਣ ਨੂੰ ਬਹੁਤ ਵਧੀਆ ਲੱਗਿਆ ਹੈਰਾਨ ਹੋ ਗਿਆ ਕਿ ਇਹ ਕਿੱਦਾਂ ਦੇ ਤਾਰੇ ਜਿਹੜੇ ਆ ਇੱਕ ਲੜੀ ਦੇ ਵਿੱਚ ਚੱਲਦੇ ਪਏ ਹੈ ਨਾ ਅਤੇ ਮੈਂ ਇਹ ਇਹ ਗੱਲ ਨੂੰ ਬੜੇ ਹੈਰਾਨੀ ਨਾਲ ਦੇਖਿਆ ਮੈਂ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕੀਤਾ ਅਤੇ ਦੂਸਰੇ ਦਿਨ ਮੈਂ ਦੋਸਤਾਂ ਨਾਲ ਗੱਲਬਾਤ ਕਰ ਰਿਹਾ ਸੀ ਕਿ ਇਹ ਤਾਰਿਆਂ ਦੀ ਲੜੀ ਸ਼ਾਮ ਨੂੰ ਰੋਜ਼ ਜਾਂਦੀ ਹੈ ਅਤੇ ਕੱਲ੍ਹ ਸ਼ਾਮ ਮੈਂ ਵੀ ਦੇਖੀ ਕੀ ਤੁਸੀਂ ਵੀ ਦੇਖੀ ਉਹ ਕਹਿੰਦੇ ਹਾਂ ਅਸੀਂ ਵੀ ਦੇਖੀ ਹੈ ਦੋ ਤਿੰਨ ਦਿਨ ਅਸੀਂ ਲਗਾਤਾਰ ਦੇਖਦੇ ਰਹੇ ਫਿਰ ਪਤਾ ਲੱਗਿਆ ਅਤੇ ਇੱਕ ਦਿਨ ਖ਼ਬਰਾਂ ਸੁਣਦੇ ਪਏ ਸੀ ਦੂਜੇ ਤੀਜੇ ਦਿਨ ਅਸੀਂ ਅਤੇ ਖ਼ਬਰਾਂ ਦੇ ਵਿੱਚ ਦੱਸਿਆ ਕਿ ਇਹ ਕਈ ਸਰਕਾਰ ਦਾ ਪ੍ਰੋਡਕਟ ਚੱਲਦਾ ਪਿਆ ਜਿਹਦੇ ਵਿੱਚ ਇ ਇਹ ਆਕਾਸ਼ ਦੇ ਵਿੱਚ ਤਾਰਾ ਝੁੰਡ ਵਰਗੀ ਇੱਕ ਸੈੱਟਲਾਈਟ ਛੱਡਿਆ ਗਿਆ ਜੋ ਕੱਲ੍ਹ ਨੂੰ ਸਾਨੂੰ ਨੈੱਟਵਰਕ ਪ੍ਰੋਵਾਈਡ ਕਰਵਾਏਗਾ ਅਤੇ ਫਿਰ ਅਸਲੀਅਤ ਪਤਾ ਲੱਗਣ 'ਤੇ ਸਾਨੂੰ ਇਹ ਲੱਗਿਆ ਕਿ ਬਹੁਤ ਵਧੀਆ ਚੀਜ਼ ਆ ਜੋ ਸਰਕਾਰ ਸਾਡੇ ਵਾਸਤੇ ਕਰ ਰਹੀ ਆ ਧੰਨਵਾਦ ਜੀ